ਹਾਂਜੀ ਮੈਮ ਹਾਂਜੀ ਹਾਂਜੀ ਮੈਮ ਹਾਂਜੀ ਮੈਮ ਹਾਂਜੀ

ਹਾਂਜੀ ਹਾਂਜੀ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਠੀਕ ਹਾਂਜੀ ਓਕੇ ਨਹੀਂ ਮੈਮ ਠੀਕ ਹੈ ਜਿਵੇਂ ਤੁਸੀਂ ਕਿਹਾ ਠੀਕ ਹੈ ਹਾਂਜੀ ਠੀਕ ਹੈ ਮੈਮ ਠੀਕ ਹੈ

ਹਾਂਜੀ ਠੀਕ ਹਾਂਜੀ ਨਹੀਂ ਮੈਮ ਬਹੁਤ ਵਧੀਆ ਵਧੀਆ ਲੱਗੀ ਜੋ ਹਾਂਜੀ ਕਰ ਲਵਾਂਗੇ ਮੈਮ ਕਰ ਠੀਕ ਹੈ ਮੈਮ